ਸਾਡੇ ਹਰ ਸਮੇਂ ਦਾ ਜਿਹੜਾ ਮਨਪਸੰਦ ਪਕਵਾਨ ਹੈ ਉਹ ਖੀਰ ਹੈ ਇੱਕ ਤਾਂ ਇਹ ਬਹੁਤ ਹੀ ਪੌਸ਼ਟਿਕ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਦੁੱਧ ਪੈਂਦਾ ਹੈ ਅਤੇ ਇਹ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋ ਸਕਦੀ ਹੈ ਅਤੇ ਇਹਦੇ ਵਿੱਚ ਡਰਾਈ ਫਰੂਟ ਪਾ ਕੇ ਇਹ ਬਹੁਤ ਹੀ ਪੌਸ਼ਟਿਕ ਹੋ ਜਾਂਦੀ ਹੈ